ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਆਂਟੀ ਜੀ ਹੋਰ ਸੁਣਾਓ ਠੀਕ ਹੋ ਤੁਸੀਂ ਹਾਂਜੀ ਹਾਂਜੀ ਠੀਕ ਹੈ ਹਾਂਜੀ ਜੀ ਹਾਂਜੀ ਬੱਚੇ ਵੀ ਠੀਕ ਹੈ ਉਹ ਨਾ ਮੈਂ ਤੁਹਾਨੂੰ ਪੁੱਛਣਾ ਸੀ ਥੋੜ੍ਹਾ ਜਿਹਾ ਸਕੂਲ ਬਾਰੇ ਬੱਚਿਆਂ ਨੂੰ ਐਡਮਿਸ਼ਨ ਕਰਵਾਉਣੀ ਸੀ ਕਿਹੜੇ ਸਕੂਲ ਮਤਲਬ ਗੁਰਦਾਸਪੁਰ ਵਧੀਆ ਹੈਗੇ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਜੀ ਹੋਰ ਬਸ ਠੀਕ ਹੈ ਮੈਨੂੰ ਹੋਰ ਵੀ ਕਿਸੇ ਨੇ ਕਿਹਾ ਵੀ ਹੋਰ ਵੀ ਸਕੂਲ ਹੈਗੇ ਗੁਰਦਾਸਪੁਰ 'ਚ ਤਿੰਨ ਚਾਰ ਸਕੂਲਾਂ ਦੇ ਉਹਨਾਂ ਨੇ ਨਾਮ ਲਏ ਹੈਗਾ ਹੈ ਅਤੇ ਹਾਂਜੀ ਵੀ ਮਤਲਬ ਉੱਥੇ ਫੀਸ ਕਿੰਨੀ ਕੁ ਹੈਗੀ ਵੈਸੇ ਲਿਟਲ ਫਲਾਵਰ ਸਕੂਲ ਦੀ ਹਾਂਜੀ ਅਤੇ ਉੱਥੇ ਮਤਲਬ ਉਹ ਹੈ ਟ੍ਰਾਂਸਪੋਰਟ ਦੀ ਫਸਿਲਟੀਜ਼ ਹੈਗੀ ਹੈ ਸਕੂਲ 'ਚ ਔਰ ਉਹ ਫਿਰ ਤੁਹਾਨੂੰ ਥੋੜ੍ਹੀ ਪ੍ਰੋਬਲਮ ਹੋ ਜਾਂਦੀ ਨਾ ਫਿਰ ਟ੍ਰਾਂਸਪੋਰਟ ਫਸਲਿਟੀ ਵੀ ਚਾਹੀਦੀ ਨਾਲ ਸਾਨੂੰ ਜ਼ਰੂਰੀ ਹਾਂਜੀ ਉਹ ਵੀ ਸਕੂਲ ਵਧੀਆ ਹੈਗਾ ਐੱਚ ਆਰ ਏ ਸਕੂਲ ਹਾਂਜੀ ਅਤੇ ਉੱਥੇ ਸਕੂਲ ਵਿੱਚ ਗੇਮ ਸਕੂਲ ਵਿੱਚ ਗੇਮਸ ਵਗੈਰਾ ਹੈਗੀਆਂ ਉੱਥੇ ਨਹੀਂ ਮੈਂ ਪੁੱਛਦੀ ਪਈ ਸੀ ਕਿ ਉੱਥੇ ਮਤਲਬ ਸਕੂਲ 'ਚ ਗੇਮਸ ਵਗੈਰਾ ਹੈਗੀਆਂ ਹਾਂਜੀ ਵਧੀਆ ਫਿਰ ਤਾਂ ਕੋਈ ਗੱਲ ਨਹੀਂ ਚਲੋ ਅਸੀਂ ਵਿਜ਼ਿਟ ਕਰਕੇ ਦੇਖਦੇ ਹਾਂ ਚਲੋ ਠੀਕ ਹੈ ਸਤਿ ਸ਼੍ਰੀ ਅਕਾਲ